ਹਾਂਜੀ ਮੇਰਾ ਕੰਮ ਜਿਹੜਾ ਖੇਤੀਬਾੜੀ ਦਾ ਹੈ ਅਤੇ ਮੈਨੂੰ ਖੇਤੀਬਾੜੀ ਦੇ ਸੰਦਾਂ ਦੇ ਬਾਰੇ ਔਜ਼ਾਰਾਂ ਦੇ ਬਾਰੇ ਬਹੁਤ ਵਧੀਆ ਜਾਣਕਾਰੀ ਹੈ ਰਸੋਈ ਦੇ ਨਾਲ ਮੇਰਾ ਬਹੁਤਾ ਸੰਬੰਧ ਨਹੀਂ ਹੈ ਪਰ ਫਿਰ ਵੀ ਤੁਸੀਂ ਮੇਰੇ ਕੋਲੋਂ ਇੱਕ ਕਊਸ਼ਨ ਪੁੱਛਿਆ ਗਾ ਤਾਂ ਮੈਂ ਉਹਦਾ ਅਨਸਰ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਮੈਂ ਆਮ ਤੌਰ 'ਤੇ ਦੇਖਿਆ ਰਸੋਈ ਦੇ ਵਿੱਚ ਪਰਾਤ ਹੁੰਦੀ ਹੈ ਅਤੇ ਆਪਣਾ ਆਟੇ ਵਾਲੀ ਢੋਲੀ ਪਤੀਲੀ ਹੁੰਦੀ ਆ ਵੱਡਾ ਪਤੀਲਾ ਦੇਗ ਹੁੰਦੀ ਹੈਗੀ ਅਤੇ ਗੁੜ ਪਾਉਣ ਵਾਲੀ ਇੱਕ ਛੋਟੀ ਬ ਆ ਆਪਣਾ ਟੈਂਕੀ ਹੁੰਦੀ ਹੈਗੀ ਇਸ ਤਰ੍ਹਾਂ ਖੰਡ ਪਾਉਣ ਵਾਲੀ ਢੋਲੀ ਅਲੱਗ ਹੁੰਦੀ ਐ ਅਤੇ ਹੋਰ ਛੋਟੇ ਡੱਬੇ ਹੁੰਦੇ ਹਨ ਜਿਹਨਾਂ ਦੇ ਵਿੱਚ ਦਾਲਾਂ ਵਗੈਰਾ ਪਾ ਕੇ ਰੱਖਦੇ ਹਾਂ ਅਤੇ ਇੱਕ ਆਪਣੀ ਛੋਟੀ ਜਿਹੀ ਘਿਓ ਵਾਲੀ ਘੇਰੜੀ ਹੁੰਦੀ ਹੈ ਜਿਹਦੇ ਵਿੱਚ ਰੋਟੀਆਂ ਪਕਾਉਣ ਵੇਲੇ ਜਿਹੜਾ ਥੋੜ੍ਹਾ ਘਿਓ ਉਹਦੇ ਵਿੱਚ ਪਾਇਆ ਜਾਂਦਾ ਵੈਸੇ ਤਾਂ ਘਿਓ ਹੈਗਾ ਨਾ ਜਿਹੜਾ ਇੱਕ ਸਾਡੇ ਮਾਤਾ ਜੀ ਡੱਬੇ ਵਿੱਚ ਪਾ ਕੇ ਫਰਿਜ ਦੇ ਵਿੱਚ ਰੱਖਿਆ ਹੋਇਆ ਹੈ ਉਹ ਡੱਬੇ ਦੇ ਸਟੀਲ ਦੇ ਡੱਬੇ ਵਿੱਚੋਂ ਥੋੜ੍ਹਾ ਜਿਹਾ ਘਿਓ ਕੱਢ ਕੇ ਘੇੜਨੀ ਵਿੱਚ ਪਾ ਲੈਂਦੇ ਆ ਤਾਂ ਕਿ ਜਿਹੜਾ ਉਹ ਸਾਰਾ ਨਾ ਜਿਹੜਾ ਖ਼ਰਾਬ ਨਾ ਹੋਵੇ ਉਹ ਘੇਰੜੀ ਵਿੱਚ ਘਿਓ ਜਿਹੜਾ ਪਾ ਕੇ ਰੱਖਿਆ ਜਾਂਦਾ ਇੱਕ ਸਾਡੇ ਵੱਡੀ ਹੈ ਢੋਲੀ ਹੈ ਸਟੀਲ ਦੀ ਉਹਦੇ ਵਿੱਚ ਅਸੀਂ ਆਟਾ ਪਾਉਂਦੇ ਹੈਗੇ ਇੱਕ ਨਾਲ ਹੀ ਉਹਦੇ ਇੱਕ ਹੋਰ ਸਟੀਲ ਦੀ ਢੋਲੀ ਹੈਗੀ ਵੀਹ ਕੁ ਕਿਲੋ ਦੀ ਹੈਗੀ ਉਹਨੂੰ ਖੰਡ ਦੀ ਲਿਆ ਕੇ ਭਰ ਲੈਂਦੇ ਹੈਗੇ ਅਤੇ ਹੋਰ ਇਸ ਤੋਂ ਇਲਾਵਾ ਚਾਰ ਪੰਜ ਡੋਲੂ ਹੈ ਉਹ ਡੋਲੂਆਂ ਦੇ ਵਿੱਚ ਚਾਹ ਅਸੀਂ ਲੈ ਕੇ ਖੇਤ ਲੈ ਕੇ ਜਾਂਦੇ ਹਾਂ ਚਾਹ ਦੇ ਭਰ ਕੇ ਡੋਲੂ ਅਤੇ ਢੋਲੀਆਂ ਨੇ ਕੋਈ ਪੰਜ ਲੀਟਰ ਦੀ ਹੈ ਕੋਈ ਕਿੰਨੇ ਦੀ ਹੈ ਉਹ ਢੋਲੀ ਦੇ ਵਿੱਚ ਜਿਹੜਾ ਕੀ ਹੈ ਦੁੱਧ ਪਾ ਕੇ ਪੰਜ ਲੀਟਰ ਅਸੀਂ ਡੈਰੀ 'ਚ ਦੁੱਧ ਪਾ ਕੇ ਆਉਂਦੇ ਹੈਗੇ ਅਤੇ ਉਸ ਤੋਂ ਇਲਾਵਾ ਪੀਪੇ ਵੀ ਪਏ ਨੇ ਪੀਪਿਆਂ ਦੇ ਵਿੱਚ ਵੀ ਹੋਰ ਖਾਣ ਪੀਣ ਵਾਲਾ ਜਿਹੜਾ ਸਮਾਨ ਹੈ ਰੱਖਿਆ ਜਾਂਦਾ ਹੈ ਇੱਕ ਸਾਡੇ ਘਰ ਪਿੱਤਲ ਦੀ ਦੇਗ ਹੈ ਜਿਹਦੇ ਵਿੱਚ ਅਸੀਂ ਸ਼ਾਮ ਨੂੰ ਜਿਹੜਾ ਕੀ ਹੈ ਦੁੱਧ ਗਰਮ ਕਰਕੇ ਰੱਖਦੇ ਹਾਂ ਪਿੱਤਲ ਦੇ ਭਾਂਡੇ ਦੇ ਵਿੱਚ ਜਿਹੜਾ ਦੁੱਧ ਗਰਮ ਕਰਕੇ ਰੱਖਿਆ ਜਾਂਦਾ ਉਹ ਕਦੇ ਖ਼ਰਾਬ ਨਹੀਂ ਗਾ ਹੁੰਦਾ ਗਾ ਅਤੇ ਇਸ ਤਰ੍ਹਾਂ ਜਿਹੜੇ ਕੀ ਐ ਹੋਰ ਛੋਟੇ ਮੋਟੇ ਗਲਾਸ ਆ ਗਏ ਉਹ ਬਹੁਤ ਪਏ ਨੇ ਬਾਟੀਆਂ ਹੈਗੀਆਂ ਆਮ ਤੌਰ 'ਤੇ ਨਾ ਕਿ ਅਸੀਂ ਗਲਾਸ ਦੇ ਵਿੱਚ ਚਾਹ ਨਹੀਂ ਪੀਂਦੇ ਸਾਡੇ ਨਾ ਬਾਟੀਆਂ ਦੇ ਵਿੱਚ ਚਾਹ ਪੀਂਦੇ ਹੈਗੇ ਅਸੀਂ ਰੱਜ ਕੇ ਬਾਟੀ ਭਰ ਕੇ ਚਾਹ ਪੀਂਦੇ ਹਾਂ ਜਿਹੜੀਆਂ ਸੇਵੀਆਂ ਵਗੈਰਾ ਅਸੀਂ ਬਣਾਉਂਦੇ ਹੈਗੇ ਵੱਡੀ ਦੇਗ ਵਿੱਚ ਸੇਵੀਆਂ ਜਾਂ ਪਤੀਲੇ 'ਚ ਬਣਾਉਂਦੇ ਹਾਂ ਤੋ ਅਸੀਂ ਵੱਡੇ ਵੱਡੇ ਕੌਲਿਆਂ ਦੇ ਵਿੱਚ ਖਾਂਦੇ ਹੈਗੇ ਸਟੀਲ ਦੇ ਕੌਲੇ ਆ ਸਾਡੇ ਕੋਲ ਬਾਹਲੇ ਵੱਡੇ ਵੱਡੇ ਅਸੀਂ ਉਹਨਾਂ ਭਰ ਭਰ ਕੇ ਉਹ ਕੌਲੇ ਖਾਂਦੇ ਹੈਗੇ ਸੇਵੀਆਂ ਦੇ ਅਤੇ ਉਸ ਤੋਂ ਇਲਾਵਾ ਜਿਹੜਾ ਕੀ ਇੱਕ ਜ਼ ਜੇ ਦਹੀਂ ਪਾਉਣ ਵਾਲੇ ਸਾਡੇ ਹੋਰ ਹੈਗੇ ਹੋਰ ਟਾਈਪ ਦੇ ਹੈਗੇ ਪਿੱਤਲ ਦੇ ਹੈ ਉਹਨੂੰ ਛੰਨਾ ਬੋਲਦੇ ਹੈਗੇ ਉਹ ਵੀ ਸਾਡੇ ਘਰ ਹੈਗਾ ਗਾ ਪਿੱਤਲ ਦੇ ਵੀ ਕਾਫ਼ੀ ਭਾਂਡੇ ਨੇ ਜਿੰਨਾ ਕੁ ਮੈਨੂੰ ਪਤਾ ਗਾ ਜੀ ਧੰਨਵਾਦ